ਅਸੀਂ ਘਰ ਬਹੁਤ ਸਾਰੇ ਬੂਟੇ ਲਾਏ ਹੋਏ ਆ ਗਮਲਿਆਂ ਦੇ ਵਿੱਚ ਜਿਹਦੇ ਕਰਕੇ ਕਿ ਅਸੀਂ ਡੀ ਪੀ ਟੀ ਯੂਜ਼ ਕਰਦੇ ਐਂਗੇ ਤਾਂ ਕਿ ਜੋ ਕਿ ਪੌਦਿਆਂ ਨੂੰ ਕੋਈ ਬਿਮਾਰੀ ਨਾ ਲੱਗ ਸਕੇ ਅਤੇ ਉਹਨਾਂ ਦੀ ਜਿਹੜਾ ਪਾਣੀ ਹੈਗਾ ਖਾਦ ਅਸੀਂ ਪਾਉਂਦੇ ਰਹਿੰਦੇ ਐਗੇ ਔਰਗੈਨਿਕ ਖਾਦ ਵੀ ਆਉਂਦੀ ਹੈਗੀ ਕੇਂਚੂ ਵਾਲੀ ਖਾਦ ਆਉਂਦੀ ਹੈਗੀ ਅਤੇ ਗੰਡੋਏ ਵਾਲੀ ਖਾਦ ਵੀ ਆਉਂਦੀ ਜਿਹਨੂੰ ਆਪਾਂ ਔਰਗੈਨਿਕ ਖਾਦ ਕਹਿੰਦੇ ਐਗੇ ਅਤੇ ਉਹ ਬਹੁਤ ਫਾਇਦੇਮੰਦ ਹੁੰਦੀ ਹੈ ਨੈਚੁਰਲੀ ਜਿਹੜਾ ਆਪਾਂ ਮਤਲਬ ਕੋਈ ਵੀ ਆਪਾਂ ਸਬਜ਼ੀ ਲਾਉਣੀ ਹੈ ਆਪਣੀ ਹੈ ਨਾ ਤਾਂ ਉਹ ਚੀਜ਼ ਵਧੀਆ ਬਣ ਜਾਂਦੀ ਹੈ ਉਹਦੇ ਨਾਲ ਉਸ ਪੌਦੇ ਨੂੰ ਕੋਈ ਰੁਕਾਵਟ ਨਹੀਂ ਆਉਂਦੀ ਅੱਗੇ ਵਧਣ 'ਚ ਅਤੇ ਹੋਰ ਵੀ ਡੀ ਪੀ ਟੀ ਖਾਦ ਪਾ ਸਕਦੇ ਹਾਂ ਆਪਾਂ ਗੋਹਾ ਪਾ ਸਕਦੇ ਹਾਂ ਮੱਝ ਦਾ ਗੋਹਾ ਬਹੁਤ ਹੀ ਫਾਇਦੇਮੰਦ ਹੁੰਦਾ ਉਹਨੂੰ ਵੀ ਆਪਾਂ ਇੱਕ ਔਰਗੈਨਿਕ ਖਾਦ ਕਹਿ ਸਕਦੇ ਐਗੇ ਪਰ ਅੱਜ ਕੱਲ੍ਹ ਕੀ ਹੈ ਕਿ ਬਹੁਤ ਸਾਰੇ ਫਾਈਟਲਾਈਜਰ ਯੂਜ ਕਰਨ ਲੱਗ ਗਏ ਹੈ ਨਾ ਜਿਹਦੇ ਕਰਕੇ ਕਿ ਬਹੁਤ ਸਾਰੀਆਂ ਬਿਮਾਰੀਆਂ ਆ ਗਈਆਂ ਤਾਂ ਮੈਂ ਤਾਂ ਇਹੀ ਚਾਹਵਾਂਗਾ ਕਿ ਆਪਾਂ ਨੂੰ ਔਰਗੈਨਿਕ ਖਾਦ ਹੀ ਯੂ ਯੂਜ ਕਰਨੀ ਚਾਹੀਦੀ ਹੈ